ਬ੍ਰਹਿਮੰਡ ਬਾਰੇ ਕੁਝ ਚੀਜ਼ਾਂ ਹਨ ਜੋ ਕਿ ਅਜੇ ਵੀ ਅਣਸੁਲਝੀਆਂ ਨੇ ਜਿਵੇਂ ਕਿ ਹਾਲੇ ਤੱਕ ਇਹ ਵੀ ਅਣਸੁਲਝਿਆ ਕਿ ਕਿਸੇ ਹੋਰ ਗ੍ਰਹਿ 'ਤੇ ਜੀਵਨ ਹੈ ਉੱਥੇ ਪਾਣੀ ਹੈ ਹਵਾ ਤਾਂ ਹਾਲੇ ਕੋਈ ਵੀ ਇਹੋ ਜਿਹੀ ਸਾਨੂੰ ਕੋਈ ਉੱਥੇ ਇਹੋ ਜਿਹਾ ਨਹੀਂ ਸੋਚਣ ਜਾਂ ਦੇਖਣ ਨੂੰ ਨਹੀਂ ਮਿਲ ਸਕਿਆ ਕਿ ਉੱਥੇ ਜੀਵਨ